ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਪਾਹੁਲਪ੍ਰੀਤ ਸਿੰਘ ਬੋਲ ਰਿਹਾ ਤੁਸੀਂ ਅਮਨ ਜੀ ਬੋਲ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਨਾ ਸਰ ਜੀ ਮੇਰਾ ਨਾ ਕੋਈ ਗੱਲ ਪੁੱਛਣੀ ਸੀਗੀ ਕਿ ਮੈਂ ਨਾ ਕਪੂਰਥਲਾ ਦੇ ਇਤਿਹਾਸ ਨਾ ਅਤੇ ਇੱਥੇ ਮੌਜੂਦ ਇਤਿਹਾਸਿਕ ਗੁਰਦੁਆਰਿਆਂ ਬਾਰੇ ਜਾਣਕਾਰੀ ਚਾਹੁੰਦਾ ਹਾਂ ਸਰ ਜੀ ਮੈਨੂੰ ਥੋੜ੍ਹੀ ਇੱਕ ਆਰਟੀਕਲ 'ਚ ਲਿਖਣਾ ਸੀ ਉਹਦੇ ਬਾਰੇ ਮੈਨੂੰ ਜਾਣਕਾਰੀ ਚਾਹੀਦੀ ਸੀਗੀ ਗੁਰਦੁਆਰਿਆ ਬਾਰੇ ਇਤਿਹਾਸਿਕ ਕਪੂਰਥਲੇ ਦੇ ਗੁਰਦੁਆਰਿਆਂ ਬਾਰੇ ਤੁਸੀਂ ਮੈਨੂੰ ਸਰ ਜੀ ਦੱਸ ਪਾਓਂਗੇ ਅਗਰ ਤੁਹਾਡੇ ਕੋਲ ਥੋੜ੍ਹਾ ਟਾਈਮ ਹੈਗਾ ਵਾ ਅੱਛਾ ਸਰ ਜੀ ਇਹ ਤਾਂ ਬਹੁਤ ਵਧੀਆ ਦਿਲਚਸਪ ਤੁਸੀਂ ਗੱਲ ਦੱਸੀ ਸਰ ਜੀ ਤੁਸੀਂ ਮੈਨੂੰ ਇਹ ਨਹੀਂ ਪਤਾ ਸੀ ਸਰ ਜੀ ਤੁਸੀਂ ਇੱਕ ਇੱਥੇ ਜਿਹੜੇ ਮੌਜੂਦ ਜਿਹੜੇ ਪ੍ਰਸਿੱਧ ਸੀ ਗੁਰਦੁਆਰੇ ਹੈਗੇ ਆ ਜਿਹੜੇ ਮਤਲਬ ਇਸ ਟੈਮ ਹੈਗੇ ਆ ਉਹਨਾਂ ਬਾਰੇ ਕੋਈ ਦੱਸ ਸਕਦੇ ਹੋ ਸਰ ਤੁਸੀਂ ਮੈਨੂੰ ਵਾਹ ਸਰ ਜੀ ਵਾਹ ਇਹ ਸੁਣ ਕੇ ਤਾਂ ਬਹੁਤ ਚੰਗਾ ਲੱਗਿਆ ਸਰ ਜੀ ਸਰ ਜੀ ਮੈਂ ਇੱਕ ਹੋਰ ਗੱਲ ਪੁੱਛਣੀ ਸੀ ਅਗਰ ਕੋਈ ਬੰਦਾ ਜਾਣਾ ਚਾਹਵੇ ਇਹਨਾਂ ਨੂੰ ਮਤਲਬ ਗੁਰਦੁ ਗੁਰਦੁਆਰਾ ਦੇ ਦਰਸ਼ਨ ਕਰਨਾ ਚਾਹਵੇ ਮੈਂ ਪੁੱਛਣਾ ਚਾਹੁੰਦਾ ਸੀ ਕਿ ਜਿਹੜੇ ਸਾਰੇ ਗੁਰਦੁਆਰੇ ਆ ਉਹ ਸ਼ਹਿਰ ਦੇ ਅੰਦਰ ਹੀ ਆ ਮਤਲਬ ਕਿ ਸ਼ਹਿਰ ਦੇ ਬਾਹਰ ਸ਼ਹਿਰ ਦੇ ਕਿੱਥੇ ਕ ਮਤਲਬ ਲੋਕੇਸ਼ਨ ਕਿੱਥੇ ਹੈਗੀ ਇਹਨਾਂ ਗੁਰਦੁਆਰਿਆਂ ਦੀ ਅੱਛਾ ਸਰ ਜੀ ਸਰ ਜੀ ਇਹ ਨਾ ਜਿਹੜੇ ਗੁਰਦੁਆਰੇ ਹੈਗੇ ਆ ਇਹਨਾਂ 'ਚ ਕੋਈ ਮਤਲਬ ਵਿਸ਼ੇਸ਼ ਸਮਾਗਮ ਵੀ ਹੁੰਦੇ ਹੈਗੇ ਆ ਅੱਛਾ ਬਹੁਤ ਧੰਨਵਾਦ ਸਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ